ਮੈਂ ਰੱਜਤ ਕੁਮਾਰ ਪਿੰਡ ਟੌਂਸਾ ਜ਼ਿਲ੍ਹਾ ਐਸਬੀਐਸ ਨਗਰ ਤੋਂ ਬੋਲਦਾ ਮੈਂ ਬਾਬੇ ਦੇ ਢਾਬੇ ਤੋਂ ਆਪਣੇ ਰਿਸ਼ਤੇਦਾਰਾਂ ਵਾਸਤੇ ਰੋਟੀ ਔਰਡਰ ਕਰੀ ਸੀਗੀ ਔਰਡਰ ਤੁਹਾਡਾ ਸਮੇਂ ਤੋਂ ਵੀ ਲੇਟ ਹੋ ਗਿਆ ਟੈਮ ਨਾਲ ਨਹੀਂ ਪਹੁੰਚਿਆ ਜੀ ਮੇਰੇ ਜਿਹੜੇ ਰਿਸ਼ਤੇਦਾਰ ਹੈਗੇ ਆ ਉਹ ਚਲੇ ਗਏ ਅਤੇ ਉਹਨਾਂ ਨੂੰ ਕਿਆ ਕਹਿੰਦੇ ਆ ਬ ਲੈਂਚ ਨਹੀਂ ਮਿਲਿਆ ਅਤੇ ਉਹ ਬਹੁਤ ਮੇਰੇ ਤੇ ਨਰਾਜ਼ ਸਨ ਅਤੇ ਮੈਨੂੰ ਵੇ ਬਹੁਤ ਬੇਸ਼ਰਮੀ ਮਹਿਸੂਸ ਹੋਈ ਅਤੇ ਉਹ ਚਲੇ ਗਏ ਹਨ ਅਤੇ ਔਰਡਰ ਹੁਣ ਮੈਂ ਕੈਂਸਲ ਕਰਵਾਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਤੁਸੀਂ ਆਪਣੇ ਸਟਾਫ ਨੂੰ ਪਨਿਸ਼ ਕਰਿਓ ਅਤੇ ਉਹਨਾਂ ਨੂੰ ਕਹੋ ਕਿ ਇੱਦਾਂ ਨਾ ਕਰਿਆ ਕਰਨ ਇੱਦਾਂ ਬੰਦੇ ਦੀ ਕਹਿੰਦੇ ਵੀ ਉਹ ਹੋ ਜਾਂਦੀ ਆ ਬੇਸਤੀ ਹੋ ਜਾਂਦੀ ਆ